ਭਾਰਤ ਦੀ ਜ਼ਿਆਦਾਤਰ ਆਬਾਦੀ ਜੋ ਹੈ ਉਹ ਰੇਲਗੱਡੀ ਰਾਹੀਂ ਸਫਰ ਕਰਨਾ ਬਹੁਤ ਪਸੰਦ ਕਰਦੇ ਨੇ ਇਹ ਸਭ ਤੋਂ ਸਸਤਾ ਪਬਲਿਕ ਟ੍ਰਾਂਸਪੋਰਟੇਸ਼ਨ ਮੋਡ ਹੈ ਜਿਵੇਂ ਕਿ ਹਵਾਈ ਜਹਾਜ਼ ਰਾਹੀਂ ਵੀ ਯਾਤਰਾ ਕੀਤੀ ਜਾ ਸਕਦੀ ਹੈ ਬਟ ਉਹ ਬਹੁਤ ਮਹਿੰਗੀ ਹੈ ਅਤੇ ਹਰ ਚਾਂਸ ਦਾ ਬੰਦਾ ਉਸਨੂੰ ਅਫੋਡ ਨਹੀਂ ਕਰ ਸਕਦਾ ਬਟ ਰੇਲਗੱਡੀ ਰਾਹੀਂ ਯਾਤਰਾ ਗਰੀਬ ਤੋਂ ਗਰੀਬ ਵਰਗ ਦਾ ਬੰਦਾ ਵੀ ਕਰ ਸਕਦਾ ਹੈ ਅਸੀਂ ਵੀ ਪਿਛਲੇ ਮਹੀਨੇ ਰੋਪੜ ਤੋਂ ਮਥੁਰਾ ਤੱਕ ਦੀ ਯਾਤਰਾ ਰੇਲਗੱਡੀ ਰਾਹੀਂ ਕੀਤੀ ਸੀ ਜੋ ਕਿ ਬਹੁਤ ਹੀ ਆਰਾਮਦਾਇਕ ਸੀ ਅਸੀਂ ਟਿਕਟਸ ਦੀ ਜੋ ਬੁਕਿੰਗ ਹੈ ਉਹ ਐਡਵਾਂਸ ਵਿੱਚ ਹੀ ਕਰ ਲਈ ਸੀ ਜਿਸ ਨਾਲ ਸਾਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਸਾਡੇ ਕੋਲ ਇੱਕ ਕੰਨਫਰਮ ਟਿਕਟ ਸੀ ਜਿਸ ਨਾਲ਼ ਸਾਡੀ ਯਾਤਰਾ ਬਹੁਤ ਹੀ ਆਰਾਮਦਾਇਕ ਹੋਈ ਰੋਪੜ ਤੋਂ ਨਵੀਂ ਦਿੱਲੀ ਤੱਕ ਅਸੀਂ ਇੱਕ ਟਰੇਨ ਵਿੱਚ ਗਏ ਜਿਸ ਦੇ ਵਿੱਚ ਸਫਰ ਬਹੁਤ ਹੀ ਆਰਾਮਦਾਇਕ ਸੀ ਸਾਨੂੰ ਖਾਣ ਲਈ ਖਾਣਾ ਵੀ ਮਿਲਿਆ ਜੋ ਕਿ ਬਹੁਤ ਸਾਫ ਸੁਥਰਾ ਸੀ ਜਿਸ ਨਾਲ਼ ਸਾਡੇ ਸਫਰ ਦਾ ਆਨੰਦ ਹੋਰ ਵਧੀਆ ਹੋ ਗਿਆ ਨਵੀਂ ਦਿੱਲੀ ਸਟੇਸ਼ਨ ਤੋਂ ਮਥੁਰਾ ਲਈ ਅਸੀਂ ਸੱਚਖੰਡ ਐਕਸਪ੍ਰੈਸ ਲਈ ਜਿਸ ਵਿੱਚ ਸਨਿਪਰ ਬਰਥ ਸੀ ਉਹ ਬਹੁਤ ਹੀ ਆਰਾਮਦਾਇਕ ਸੀ ਅਸੀਂ ਆਰਾਮ ਨਾਲ਼ ਲੇਟ ਕੇ ਆਪਣਾ ਸਫਰ ਤੈਅ ਕੀਤਾ ਸਫਰ ਦੀ ਥਕਾਨ ਵੀ ਸਾਨੂੰ ਮਹਿਸੂਸ ਨਹੀਂ ਹੋਈ ਜਿਵੇਂ ਕਿ ਐਡਵਾਂਸ ਦੇ ਵਿੱਚ ਹੀ ਅਸੀਂ ਸੀਟਸ ਦੀ ਬੁਕਿੰਗ ਕੀਤੀ ਹੋਈ ਸੀ ਇਸ ਨਾਲ਼ ਸਾਨੂੰ ਅੱਗੇ ਪਹੁੰਚਣ ਵਿੱਚ ਵੀ ਕੋਈ ਦਿੱਕਤ ਨਹੀਂ ਹੋਈ ਅਤੇ ਟਰੇਨ ਦੇ ਅੰਦਰ ਦਾ ਮਾਹੌਲ ਵੀ ਬਹੁਤ ਵਧੀਆ ਸੀ ਸਾਨੂੰ ਆਪਣੀ ਸੇਫਟੀ ਦੀ ਵੀ ਕੋਈ ਟੈਂਸ਼ਨ ਨਹੀਂ ਹੋਈ ਉੱਥੇ ਅਤੇ ਆਪਣੇ ਸਮਾਨ ਦੀ ਵੀ ਕੋਈ ਟੈਂਸ਼ਨ ਨਹੀਂ ਹੋਈ ਭਾਰਤ ਦਾ ਰੇਲ ਨੈਟਵਰਕ ਜੋ ਹੈ ਉਹ ਦੁਨੀਆਂ ਦਾ ਇੱਕ ਕਾਫੀ ਵੱਡਾ ਰੇਲ ਨੈਟਵਰਕ ਹੈ ਅਤੇ ਕਾਫੀ ਤੇਜ਼ੀ ਨਾਲ ਤਰੱਕੀ ਵੀ ਕਰ ਰਿਹਾ ਹੈ ਆਉਣ ਵਾਲ਼ੇ ਸਮੇਂ ਦੇ ਵਿੱਚ ਇਹ ਹੋਰ ਤਰੱਕੀ ਕਰ ਸਕਦਾ ਹੈ ਜਿਵੇਂ ਕਿ ਰੀਸੈਂਟਲੀ ਹੀ ਬੰਦੇ ਭਾਰਤ ਟਰੇਨ ਜੋ ਹੈ ਉਹ ਵੀ ਲੋਂਚ ਹੋਈ ਹੈ ਜਿਸ ਨਾਲ਼ ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣਾ ਜੋ ਹੈ ਉਹ ਬਹੁਤ ਹੀ ਆਸਾਨ ਅਤੇ ਆਰਾਮਦਾਇਕ ਹੋ ਗਿਆ ਹੈ ਰੇਲ ਨੈਟਵਰਕ ਜੋ ਹੈ ਉਸਦੇ ਉੱਤੇ ਬਹੁਤ ਸਾਰੇ ਲੋਕ ਜੋ ਹੈ ਉਹ ਡਿਪੈਂਡੈਂਟ ਨੇ ਅਤੇ ਉਸ ਵਿੱਚ ਯਾਤਰਾ ਕਰਨੀ ਬਹੁਤ ਪਸੰਦ ਕਰਦੇ ਨੇ